ਮੇਰੇ ਖਿਆਲ ਵਿੱਚ ਪੰਜਾਬੀ ਭਾਸ਼ਾ ਭਾਰਤ ਦੇ ਵੱਖ ਵੱਖ ਹਿੱਸਿਆਂ ਅਤੇ ਸੱਭਿਆਚਾਰ ਵਟਾਂਦਰੇ ਵਿੱਚ ਸੰਚਾਰ ਦੀ ਭੂਮਿਕਾ ਵਿੱਚ ਵਾਹਵਾ ਭੂਮਿਕਾ ਹੈ ਨਿਭਾਉਂਦੀ ਹੈ ਕਿਉਂਕਿ ਸਾਡੇ ਪੰਜਾਬ ਵਿੱਚ ਪੰਜਾਬੀ ਬੋ ਬੋਲੀ ਹੀ ਮਾਂ ਬੋਲੀ ਹੈ ਜਿਸ ਨੂੰ ਮ ਮਾਂ ਬੋਲੀ ਹੈ ਅਤੇ ਅਸ ਆਪਾਂ ਦੇਖਦੇ ਵੀ ਹਾਂ ਕਿ ਜਿਹੜਾ ਜਿਹਨੂੰ ਪੰਜਾਬੀ ਬੋਲਣੀ ਹੈ ਉਸ ਲਈ ਉਹਨੂੰ ਉਹਨੂੰ ਹੀ ਪੰਜਾਬ ਦਾ ਕਿਹਾ ਜਾਂਦਾ ਹੈ ਪੰਜਾਬ ਦਾ ਇਨਸਾਨ ਕਿਹਾ ਜਾਂਦਾ ਕਿ ਉਹ ਪੰਜਾਬੀ ਹੈ ਇਸ ਲਈ ਸਾਡੇ ਆਪਦੇ ਦ ਦੇਖਦੇ ਹਾਂ ਕਿ ਜਦੋਂ ਗਿੱਧਾ ਬੋਲਦਾ ਹੈ ਗਿੱਧਾ ਪੈਂਦਾ ਹੈ ਤਾਂ ਉਹਦੇ ਵਿੱਚ ਵੀ ਪੰਜਾਬੀ ਬੋਲੀਆਂ ਬੋਲੀ ਜਾਂਦੀ ਹੈ ਅਤੇ ਮਾਝਾ ਮਲਵਈ ਦੁਆਬੇ ਵਿੱਚ ਵੀ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਇਸ ਲਈ ਆਪਾਂ ਸਾਨੂੰ ਆਪਣੇ ਬਹੁਤ ਮਾਣ ਹੈ ਕਿ ਆਪਾਂ ਪੰਜਾਬੀ ਹਾਂ ਤਾਂ ਜੋ ਆਪਾਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਆਪਾਂ ਪੰਜਾਬੀ ਬੋਲ ਸਕਦੇ ਹਾਂ ਇਸ ਲਈ ਆਪਾਂ ਦੇਖਦੇ ਹਾਂ ਕਿ ਸਾਡੇ ਗੁਰੂਆਂ ਗੁਰੂਆਂ ਨੇ ਵੀ ਸਾਡੇ ਧਰਮ ਨੂੰ ਬਚਾਉਣ ਲਈ ਪੰਜਾਬੀ ਵਿੱਚ ਸਾਡੇ ਗੁਰੂਆਂ ਨੇ ਵੀ ਧਰਮ ਨੂੰ ਬਚਾਉਣ ਲਈ ਪੰਜਾਬੀ ਵਿੱਚ ਗੁਰਬਾਣੀ ਲਿਖੀ ਹੈ ਅਤੇ ਤਾਂ ਜੋ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ ਅਤੇ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਅਤੇ ਹੋਰ ਆਪਾਂ ਪੜ੍ਹ ਕੇ ਗੁਰਬਾਣੀ ਨੂੰ ਪੜ੍ਹ ਕੇ ਆਪਾਂ ਸਬਰ ਸੰਤੋਖ ਰਹਿ ਰਹਿ ਸਕਦੇ ਹਾਂ ਵਿਵੇਕ ਵਿਵੇਕ ਪ ਪ੍ਰਾਪਤ ਕਰ ਸਕਦੇ ਹਾਂ ਅਤੇ ਸ ਸੰਤੋਖ ਪ੍ਰਾਪਤ ਕਰ ਸਕਦੇ ਸਬਰ ਬਰ ਪ੍ਰਾਪਤ ਕਰ ਸਕਦੇ ਹਾਂ ਅਤੇ ਹੋਰ ਵੀ ਸਨ ਸਾਨੂੰ ਪੰਜਾਬੀ ਇਸ ਲਈ ਬੋਲਣੀ ਚਾਹੀਦੀ ਹੈ ਤਾਂ ਜੋ ਸਾਡਾ ਮਾਣ ਵਧੇ ਕਿਉਂਕਿ ਆਪਾਂ ਪੰਜਾਬੀ ਹਾਂ ਪੰਜਾਬੀ ਨੂੰ ਕੋਈ ਸ਼ਰਮ ਨਹੀਂ ਆਉਂਦੀ ਪੰਜਾ ਪ ਪੰਜਾਬੀ ਨੂੰ ਕੋਈ ਸ਼ਰਮ ਨਹੀਂ ਆਉਂਦੀ ਪੰਜਾਬੀ ਬੋਲਣ ਲਈ ਕਿਉਂਕਿ ਜਦੋਂ ਵੀ ਕੋਈ ਬਾਹਰੋਂ ਫੋਰਨ ਆਉਂਦਾ ਹੈ ਤਾਂ ਉਹਨੂੰ ਪੰਜਾਬੀ ਬੋਲਣ ਵਿੱਚ ਬਹੁਤ ਦਿੱਕਤ ਹੁੰਦੀ ਹੈ ਇਸ ਲਈ ਸਾਨੂੰ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਪੰਜਾਬੀ ਕਿਵੇਂ ਬੋਲੀ ਜਾਂਦੀ ਹੈ ਇਸ ਲਈ ਸਾਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ ਅਤੇ ਅੱਗੇ ਸਿਖਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਪੰਜਾਬੀ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਪੰਜਾਬੀ ਬੋਲਦੇ ਹਨ ਕਿਉਂਕਿ ਪੰਜਾਬੀ ਤੋਂ ਬਿਨਾ ਪੰਜਾਬ ਵਿੱਚ ਕੋਈ ਇਹੋ ਜਿਹਾ ਇਨਸਾਨ ਨਹੀਂ ਹੋਏਗਾ ਜਿਹਨੂੰ ਪੰਜਾਬੀ ਨਹੀਂ ਆਉਂਦੀ ਹੋਵੇਗੀ ਥੈਂਕ ਯੂ